ਹਰ ਕੋਈ ਮਤਲਬ ਆਪਣੇ ਖੇਡ ਦੇ ਵਿੱਚ ਮਹਾਨ ਸ਼ਖਸੀਅਤ ਰੱਖਦਾ ਹੈ ਹਰ ਕੋਈ ਬਹੁਤ ਵਧੀਆ ਤਰ੍ਹਾਂ ਆਪਣੀ ਖੇਡ ਨੂੰ ਪ੍ਰਜੈਂਟ ਕਰਦਾ ਹੈ ਪਰ ਕਹਿੰਦੇ ਨੇ ਨਾ ਵੀ ਜਿਹੜਾ ਬੈਸਟ ਹੁੰਦਾ ਉਹ ਤਾਂ ਕੋਈ ਇੱਕ ਹੀ ਹੁੰਦਾ ਜਿਹੜਾ ਜਿਸਨੂੰ ਆਪਾਂ ਕਹਿ ਸਕਦੇ ਹਾਂ ਵੀ ਹਾਂ ਵੀ ਇਹ ਸਭ ਤੋਂ ਬੈਸਟ ਹੈ ਤਾਂ ਮੈਨੂੰ ਇੱਕ ਯਾਦ ਹੈ ਨਾਮ ਦਵਿੰਦਰ ਸਿੰਘ ਨਾਮ ਕਰਕੇ ਕੋਈ ਹੈਗਾ ਅਤੇ ਉਹ ਮਤਲਬ ਕਿ ਉਹ ਇੰਡੀਅਨ ਜਿਹੜਾ ਹੈਗਾ ਟਰੈਕ ਅਤੇ ਫੀਲਡ ਅਥਲੀਟ ਸੀਗਾ ਜਿਹੜਾ ਕਿ ਅ ਉਹ ਹੁੰਦੀ ਹੈ ਜੈਵਲਿਨ ਥਰੋਇੰਗ ਹੁੰਦੇ ਨੇ ਨਾ ਈਵੈਂਟ ਉਹ ਕਰਦਾ ਸੀਗਾ ਅਤੇ ਮਤਲਬ ਇੰਨਾ ਮਤਲਬ ਇੱਕ ਦੋ ਵਾਰੀ ਮੈਨੇ ਦੇਖਿਆ ਥੋੜ੍ਹਾ ਜਿਹਾ ਅਤੇ ਫਿਰ ਮੈਂ ਸਰਚ ਕੀਤਾ ਵੀ ਹੈ ਨਾ ਵੀ ਕਿਵੇਂ ਹੈਗਾ ਅਤੇ ਉਹ ਕਾਫੀ ਜ਼ਿਆਦਾ ਅੱਛੀ ਮਤਲਬ ਆਪਣੀ ਗੇਮ ਦੇ ਵਿੱਚ ਖੇਡਦਾ ਸੀਗਾ ਅਤੇ ਜਦੋਂ ਮੈਂ ਦੋ ਹਜ਼ਾਰ ਸਤਾਰਾਂ 'ਚ ਦੇਖਿਆ ਸੀ ਮੈਨੇ ਵਰਲਡ ਅਥਲੈਟਿਕਸ ਚੈਂਪੀਅਨ ਹੁੰਦੇ ਨੇ ਨਾ ਉਹ ਪਹਿਲਾ ਇੰਡੀਅਨ ਬਣਿਆ ਜਿਸਨੇ ਵਰਲਡ ਅਥਲੈਟਿਕਸ ਚੈਂਪੀਅਨਸ 'ਚ ਗਿਆ ਕੁਆਲੀਫਾਈ ਹੋਇਆ ਠੀਕ ਹੈ ਅਤੇ ਉਹ ਸੈਵੇਂਥ ਬੈਸਟ ਮਾਰਕ ਕੁਆਲੀਫਾਇੰਗ ਰਾਊਂਡ ਦੇ ਵਿੱਚ ਕੁਛ ਐਦਾਂ ਕਰਕੇ ਸੀਗਾ ਅਤੇ ਇੱਕ ਮੈਨੂੰ ਜੋ ਦਸਤਾਰ ਵਾਲੀ ਕੁੜੀ ਦਾ ਨੇਮ ਵੀ ਯਾਦ ਹੈ ਗੁਰਮੀਤ ਕੌਰ ਉਹ ਮਤਲਬ ਉਹ ਦੀਦੀ ਬਹੁਤ ਉਹ ਕਾਫੀ ਅੱਛੇ ਸੀ ਉਹ ਵੀ ਜੈਵਲਿਨ ਦੇ ਸੀ ਕਿਉਂਕਿ ਮੈਂ ਜਦੋਂ ਦਵਿੰਦਰ ਸਿੰਘ ਬਾਰੇ ਪੜ੍ਹ ਰਹੀ ਸੀ ਫਿਰ ਮੈਂ ਨਾਲ ਨਾਲ ਫਿਰ ਮੈਨੂੰ ਪਤਾ ਲੱਗਿਆ ਉਹ

ਜਿਹੜੇ ਸੀ ਉਹ ਵੀ ਥਰੋਅਰ ਸੀਗੇ ਠੀਕ ਹੈ ਅਤੇ ਉਹਨਾਂ ਨੇ ਆਪਣਾ ਰਿਕੋਡ ਸੈੱਟ ਕੀਤਾ ਸੀਗਾ ਸਟਰੇਟ ਫਿਫਟੀ ਏਟ ਪੁਆਇੰਟ ਕੁਛ ਇੱਦਾਂ ਕਰਕੇ ਮੀਟਰਸ 'ਤੇ ਸਤਾਰਾਂ ਜੁਲਾਈ ਨੂੰ ਦੋ ਹਜ਼ਾਰ ਦੇ ਵਿੱਚ ਅਤੇ ਬੈਂਗਲੌਰ ਦੇ ਵਿੱਚ ਨੈਸ਼ਨਲ ਰਿਕੋਡ ਸੀਗਾ ਦੋ ਹਜ਼ਾਰ ਚੌਦਾਂ ਤੱਕ ਜਿਹੜਾ ਮਤਲਬ ਉਸ ਤੋਂ ਬਾਅਦ ਉਹਨਾਂ ਨੇ ਹੋਰ ਰਿਕਾਰਡ ਕੀਤਾ ਸੀਗਾ ਅਤੇ ਇੱਕ ਹੋਰ ਜੋ ਇੰਡੀਅਨ ਅਥਲੀਟ ਅਤੇ ਰਨਰ ਕਹਿ ਸਕਦੇ ਜਿਸਨੂੰ ਆਪਾਂ ਉਹ ਖੁਸ਼ਬੀਰ ਕੌਰ ਉਹ ਨੇ ਮਤਲਬ ਵੀਹ ਕਿਲੋਮੀਟਰ ਕੁਛ ਇੱਦਾਂ ਕਰਕੇ ਰਨਰ ਆਫ ਵੀਹ ਕਿਲੋਮੀਟਰ ਸੀਗੇ ਅਤੇ ਕਾਫੀ ਜ਼ਿਆਦਾ ਮਤਲਬ ਉਹ ਕਹਿੰਦੇ ਵੀ ਠੱਲ ਮਾਈਲਸ ਰਨ ਕਰ ਸਕਦੀ ਸੀ ਉਹ ਅਤੇ ਇੱਕ ਹੋਰ ਜੈਵਲਿਨ ਥਰੋ ਦੇ ਵਿੱਚ ਹੀ ਦੱਸ ਦਿੰਦੀ ਹਾਂ ਉਹ ਹੈਗਾ ਰਵਿੰਦਰ ਸਿੰਘ ਮੁੰਡਾ ਅਤੇ ਮਤਲਬ ਇਹ ਜਿਨ੍ਹਾਂ ਜਿਨ੍ਹਾਂ ਦਾ ਮੈਂ ਨਾਮ ਲੈ ਰਹੀ ਹਾਂ ਇਹ ਆਪਣੇ ਖਿੱਤੇ ਵਿੱਚ ਮਸ਼ਹੂਰ ਨੇ ਖਿੱਤਾ ਮੀਨਸ ਕਿ ਆਪਣੀ ਸਪੋਰਟਸ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਨੇ ਵੀ ਅੱਛਾ ਕੀਤਾ ਹੋਇਆ ਹੈਗਾ ਅਤੇ ਆਪਣੇ ਪੇਰੈਂਟਸ ਦਾ ਪੇਰੈਂਟਸ ਨੂੰ ਪਰਾਊਡ ਤਾਂ ਹੁੰਦਾ ਹੀ ਹੈ ਜਦੋਂ ਉਹਨਾਂ ਦੇ ਬੱਚੇ ਜਦੋਂ ਵਰਲਡ ਦਾ ਰਿਕੋਡ ਸੈੱਟ ਕਰਦੇ ਹੈ ਨਾ ਅਤੇ ਜੇ ਮੈਂ ਕੋਚ ਦੀ ਗੱਲ ਕਰਾਂ ਤਾਂ ਉਹ ਮਤਲਬ ਐਵੇਂ ਹੁੰਦਾ ਵੀ ਉਹ ਤਾਂ ਆਪਣੇ ਕੋਚ ਆਪਾਂ ਨੂੰ ਬਹੁਤ ਵਧੀਆ ਲੱਗਦੇ ਨੇ ਅਤੇ ਜਿਹੜੇ ਮੇਰੇ ਪੰਜਾਬੀ ਯੂਨੀਵਰਸਿਟੀ ਦੇ ਕੋਚ ਨੇ ਕਾਫੀ ਜ਼ਿਆਦਾ ਵਧੀਆ ਨੇ ਠੀਕ ਹੈ ਅਤੇ ਉਹ ਮਤਲਬ ਕੋਚ ਦੀ ਪੂਰੀ ਜ਼ਿੰਮੇਵਾਰੀ ਨਿਭਾਉਣਾ ਉਹਨਾਂ ਦਾ ਫਰਜ਼ ਹੈ ਅਤੇ ਨਿਭਾਉਂਦੇ ਹੈ ਹੋਰ ਅਗਰ ਜੇ ਮੈਨੂੰ ਨੇਮ ਯਾਦ ਆਉਂਦਾ ਤਾਂ ਮੈਂ ਅਥਲੀਟ ਦਾ ਦੱਸ ਤਾ ਹੈ ਨਾ ਅਤੇ ਇਹਨਾਂ ਨੇ ਛਾਪ ਛੱਡੀ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੇ ਆਪਣੀ ਉਸ ਦੇ ਵਿੱਚ ਖੇਡਾਂ ਦੇ ਵਿੱਚ ਆਪਣੀ ਇੱਕ ਇਮੇਜ ਸੈੱਟ ਕੀਤੀ ਹੈ ਦੈਟ ਵੀ ਆਰ ਦੀ ਬੈਸਟ ਇੱਕ ਹੋਰ ਖੁਸ਼ਬੀਰ ਕੌਰ ਦਾ ਨਾਮ ਤਾਂ ਮੈਂ ਲੈ ਦਿੱਤਾ ਅਤੇ ਕਾਫੀ ਜ਼ਿਆਦਾ ਇੱਕ ਸਵਰਨ ਸਿੰਘ ਵੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਸਵਰਨ ਸਿੰਘ ਨਾਮ ਕਰਕੇ ਹੈਗੇ ਹੈ ਅਤੇ ਇੱਕ ਆਪਾਂ ਬੋਕਸਰ ਦੀ ਗੱਲ ਮੈਂ ਦੱਸ ਦਿੰਦੀ ਹਾਂ ਸਿਮਰਨਜੀਤ ਕੌਰ ਕਰਕੇ ਨਾਮ ਕੁੜੀ ਆ ਬੋਕਸਰ ਠੀਕ ਹੈ ਲੁਧਿਆਣਾ ਤੋਂ ਹੈ ਅਤੇ ਉਹਨਾਂ ਨੇ ਇੰਡੀਆ ਨੂੰ ਰੀਪ੍ਰਜੈਂਟ ਕੀਤਾ ਸੀ ਇੰਟਰਨੈਸ਼ਨਲੀ ਅਤੇ ਬਰੋਂਜ ਮੈਡਲ ਵੀ ਜਿੱਤਿਆ ਅਤੇ ਇੱਦਾਂ ਕਰਕੇ ਬਹੁਤ ਵਧੀਆ ਬਹੁਤ ਮਤਲਬ ਉੱਚੇ ਕਿਰਦਾਰ ਵਾਲੇ ਅਤੇ ਉੱਚਾ ਰੁਤਬਾ ਰੱਖਣ ਵਾਲੇ ਜਿਹੜੇ ਪਲੇਅਰਸ ਹੈ ਉਹ ਪੰਜਾਬ ਦੇ ਵਿੱਚ ਹੈਗੇ ਹੈ ਉਹ ਪੰਜਾਬ ਨੂੰ ਇੰਡੀਆ ਨੂੰ ਰੀਪ੍ਰਜੈਂਟ ਕਰਦੇ ਨੇ ਅਤੇ ਆਪਣੇ ਪੇਰੈਂਟਸ ਦਾ ਅਤੇ ਆਪਣੇ ਦੇਸ਼ ਦਾ ਨਾਮ ਜ਼ਰੂਰ ਹੀ ਰੋਸ਼ਨ ਕਰਦੇ ਨੇ ਧੰਨਵਾਦ ਜੀ